ਭੰਗੜਾ ਅਤੇ ਐਰੋਬਿਕਸ ਪੰਜਾਬੀ ਸੰਸਕ੍ਰਿਤੀ ਦੇ ਵੱਖ ਵੱਖ ਪੱਖਾਂ ਨੂੰ ਦਰਸ਼ਾਉਂਦੇ ਹਨ ਭੰਗੜਾ ਏਕ ਪਰੰਪਰਾਗਤ ਨਾਚ ਹੈ ਜੋ ਖੇਤੀਬਾੜੀ ਮੌਸਮ ਅਤੇ ਤਿਹਾਰਾਂ ਨਾਲ ਜੁੜਿਆ ਹੋਇਆ ਹੈ ਇਹ ਪੰਜਾਬੀਆਂ ਦੀ ਖੁਸ਼ਮਜਾਜੀ ਉਤਸਾਹ ਉਤਸਾਹ ਅਤੇ ਭਾਈਚਾਰੇ ਦੀ ਅਨੁਭੂਤੀ ਨੂੰ ਵਿਅਕਤ ਕਰਦਾ ਹੈ ਦੂਜੇ ਪਾਸੇ ਐਰੋਬਿਕਸ ਆਧੁਨਿਕ ਜੀਵਨ ਸ਼ੈਲੀ ਦੀ ਨਿਸ਼ਾਨੀ ਹੈ ਜੋ ਤੰਦਰੁਸਤੀ ਅਤੇ ਸ਼ਰੀਰਿਕ ਵੀ ਬਿਆਸ ਅਤੇ ਕੇਂਦਰ ਹੈ ਜਦੋਂ ਭੰਗੜੇ ਦੀ ਊਰਜਾ ਤੇ ਐਰੋਬਿਕਸ ਦੀ ਵਿਗਿਆਨਿਕ ਕਸਰਤ ਨੂੰ ਮਿਲਾ ਕੇ ਕੀਤਾ ਜਾਂਦਾ ਹੈ ਤਾਂ ਇਹ ਪੰਜਾਬ ਦੀ ਨਵੀਂ ਪੀੜੀ ਲਈ ਇੱਕੋ ਵਾਰ ਹੀ ਮਜੇ ਅਤੇ ਸਿਹਤਮੰਦਾਂ ਨੂੰ ਮਹੈਤਵ ਦਿੰਦਾ ਹੈ ਇਸ ਤਰੀਕੇ ਨਾਲ ਇਹ ਮਿਲਾਪ ਪੰਜਾਬ ਦੀ ਸੰਸਕ੍ਰਿਤੀ ਤੇ ਤੰਦਰੁਸਤੀ ਖੁਸ਼ਹਾਲੀ ਅਤੇ ਆਧੁਨਿਕਤਾ ਦੀ ਸਮਰਥਾਂ ਨੂੰ ਦਰਸ਼ਾਉਂਦਾ ਹੈ ਭੰਗੜਾ ਅਤੇ ਐਰੋਬਿਕਸ ਪੰਜਾਬੀ ਸੰਸਕ੍ਰਤੀ ਦੇ ਪੁਰਾਤਨ ਤੇ ਆਧੁਨਿਕ ਪੱਖਾਂ ਦੀ ਇੱਕ ਵਧੀਆ ਮਿਲਾਪ ਹੈ ਭੰਗੜਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਇੱਕ ਨਾਚ ਹੈ ਜੋ ਪੁਰਾਣੇ ਸਮੇਂ ਵਿੱਚ ਖੇਤੀਬਾੜੀ ਦੀ ਖੁਸ਼ੀ ਮਨਾਉਣ ਲਈ ਕੀਤਾ ਜਾਂਦਾ ਸੀ ਇਹ ਸਿਰਫ ਇੱਕ ਨਿਤਿਆ ਹੀ ਨਹੀਂ ਬਲਕਿ ਪੰਜਾਬੀਆਂ ਦੀ ਜੋਸ਼ ਉਤਸਾਹ ਅਤੇ ਜਿੰਦਾ ਦਿਲ ਤਬੀਅਤ ਨੂੰ ਦਰਸ਼ਾਉਂਦਾ ਹੈ ਦੂਜੇ ਪਾਸੇ ਐਰੋਬਿਕਸ ਅਧੁਨਿਕ ਯੁੱਗ ਦੀ ਇੱਕ ਵਿਗਿਆਨਿਕ ਬਿਧੀ ਹੈ ਜੋ ਤੰਦਰੁਸਤੀ ਫਿਟਨਸ ਅਤੇ ਸਰੀਰ ਦੀ ਚੁਸਤੀ ਤੇ ਧਿਆਨ ਕੇਂਦਰ ਕਦਰ ਹੈ ਜਦੋਂ ਇਹ ਦੋਵੇਂ ਸੈਲੀਆਂ ਮਿਲਦੀਆਂ ਹਨ ਤਾਂ ਇਹ ਦੱਸਦੀਆਂ ਹਨ ਕਿ ਪੰਜਾਬੀ ਲੋਕ ਨਵੀਆਂ ਤਰਨੀ ਤਕਨੀਕਾਂ ਨੂੰ ਵੀ ਆਪਣੇ ਪਰੰਪਰਾਵਾਂ ਨਾਲ ਜੋੜ ਕੇ ਅੱਗੇ ਵਧਦੇ ਹਨ ਭੰਗੜੇ ਦੀ ਗਤੀਸ਼ੀਲਤਾ ਅਤੇ ਐਰੋਬਿਕਸ ਦੀ ਵਿਗਿਆਨਿਕਤਾ ਮਿਲਕੇ ਸਿਹਤ ਅਤੇ ਮਨੋਰੰਜਨ ਦਾ ਵਧੀਆ ਸਹਿਯੋਗ ਬਣਾਉਣਾ ਬਣਾਉਂਦੀਆਂ ਹਨ ਅੱਜ ਦੇ ਸਮੇਂ ਵਿੱਚ ਕਈ ਯੁਵਕ ਅਤੇ ਜੁਗਤੀਆਂ ਭੰਗੜੇ ਐਰੋਬਿਕਸ ਨੂੰ ਆਪਣੇ ਦਿਨਚਰਿਆ ਦਾ ਹਿੱਸਾ ਬਣਾ ਰਹੇ ਹਨ